ਜੀ ਹਾਂ ਅਸੀਂ ਫੇਸਬੁੱਕ ਇੰਸਟਾਗ੍ਰਾਮ ਹਰ ਕੋਈ ਚਲਾਉਂਦਾ ਹੈ ਅਤੇ ਸਾਡੇ ਘਰ ਵਿੱਚ ਵੀ ਸਾਰਾ ਪਰਿਵਾਰ ਚਲਾਉਂਦਾ ਹੈ ਇਸ 'ਤੇ ਸਾਨੂੰ ਖ਼ਬਰਾਂ ਸਭ ਤੋਂ ਪਹਿਲਾਂ ਮਿਲਦੀਆਂ ਹਨ ਘਰ ਵੀ ਹੋਈਏ ਇਸ ਤਾਂ ਵੀ ਅਤੇ ਬਾਹਰ ਵੀ ਹੋਈਏ ਤਾਂ ਪਹਿਲਾਂ ਖ਼ਬਰ ਸਾਡੇ ਤੱਕ ਪਹੁੰਚਦੀ ਹੈ ਇਸ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਸਾਡੇ ਲਈ ਬਹੁਤ ਜ਼ਰੂਰੀ ਹਨ ਕਿਉਂਕਿ ਇਹਨਾਂ 'ਤੇ ਸਾਨੂੰ ਦੁਨੀਆਂ ਬਾਰੇ ਕੋਈ ਵੀ ਖ਼ਬਰ ਹੋਵੇ ਪਤਾ ਚੱਲ ਜਾਂਦੀ ਹੈ ਇਸ ਲਈ ਇਹ ਸਾਡੇ ਲਈ ਬਹੁਤ ਜ਼ਰੂਰੀ ਹੋ ਗਏ ਹਨ